ਮੈਨੂੰ ਵੈਸੇ ਹਰ ਤਰ੍ਹਾਂ ਦੇ ਪਕਵਾਨ ਬਣਾਉਣੇ ਆਉਂਦੇ ਹਨ ਜਿਹਨਾਂ ਵਿੱਚ ਮੈਂ ਭਿੰਡੀ ਦੀ ਸਬਜ਼ੀ ਆਲੂ ਮਟਰ ਪਨੀਰ ਦੀ ਸਬਜ਼ੀ ਔਰ ਬਰਗਰ ਵੀ ਥੋੜ੍ਹੇ ਬਹੁਤੇ ਬਣਾ ਲਈਦੇ ਆ ਅਤੇ ਰਹਿ ਗਈ ਗੱਲ ਸਾਗ ਉਹ ਵੀ ਮੈਂ ਸਿੱਖ ਲਿਆ ਹੁਣ ਬਣਾਉਣਾ ਅਤੇ ਜਿਹੜੇ ਕਿ ਕੁਛ ਚੀਜ਼ਾਂ ਏ ਆ ਵਿੱਚ ਜਿੱਦਾਂ ਮੈਨੂੰ ਸਾਂਬਰ ਹੋ ਗਿਆ ਇਡਲੀ ਹੋ ਗਈ ਇਹ ਚੀਜ਼ਾਂ ਮੈਨੂੰ ਨਹੀਂ ਬਣਾਉਣੀਆ ਆਉਂਦੀਆਂ ਔਰ ਕੜੀ ਕੜੀ ਬਹੁਤ ਔਖੀ ਲੱਗਦੀ ਹੈ ਮੈਨੂੰ ਬਣਾਉਣੀ ਹੈ ਨਾ ਉਹਦੇ ਵਿੱਚ ਮੈਨੂੰ ਥੋੜ੍ਹਾ ਹਿਸਾਬ ਕਿਤਾਬ ਜਿਹਾ ਨਹੀਂ ਆਉਂਦਾ ਹੈਗਾ ਕਿ ਉਹਦੇ ਵਿੱਚ ਮੈਂ ਕਿੰਨੀ ਲੱਸੀ ਪਾਵਾਂ ਕਿੰਨਾਂ ਮੈਂ ਉਹਦੇ ਵਿੱਚ ਬੇਸਣ ਪਾਵਾਂ ਇਸ ਕਰਕੇ ਮੈਂ ਉਹ ਮੈਨੂੰ ਪਕਵਾਨ ਥੋੜ੍ਹਾ ਮੁਸ਼ਕਿਲ ਲੱਗਦਾ ਏ ਆ ਮੈਂ ਉਸਨੂੰ ਬਣਾਉਣਾ ਸਿੱਖਣਾ ਚਾਹੁੰਦੀ ਹਾਂ ਅਤੇ ਉਹ ਗਾਹਾਂ ਗਾਹਾਂ ਮੈਂ ਇਹ ਕੋਸ਼ਿਸ਼ ਕਰੂੰਗੀ ਕਿ ਮੈਨੂੰ ਉਹ ਵੀ ਆ ਜਾਵੇ